ਖੇਡਾਂ ਲੋਕਾਂ ਦੇ ਜੀਵਨ ਵਿੱਚ ਬਹੁਤ ਹੀ ਮਹੱਤਵ ਸਥਾਨ ਰੱਖਦੀਆਂ ਹਨ ਜਿਵੇਂ ਕਿ ਖੇਡਾਂ ਦੇ ਨਾਲ਼ ਨਾਲ਼ ਅਸੀਂ ਬਹੁਤ ਹੀ ਵੱਖ ਵੱਖ ਤਰ੍ਹਾਂ ਦੇ ਤਰੀਕੇ ਅਤੇ ਚੰਗੀਆਂ ਆਦਤਾਂ ਨੂੰ ਅਪਣਾ ਸਕਦੇ ਹਾਂ ਖੇਡਾਂ ਦੇ ਨਾਲ਼ ਜੁੜੇ ਰਹਿਣ ਨਾਲ਼ ਸਾਡਾ ਇੱਕ ਤਾਂ ਸਰੀਰ ਤੰਦਰੁਸਤ ਰਹਿੰਦਾ ਹੈ ਅਤੇ ਹੋਰ ਹੀ ਹੋਰ ਤਰ੍ਹਾਂ ਦੀਆਂ ਖੂਬੀਆਂ ਵੀ ਅਪਣਾਈਆਂ ਜਾਂਦੀਆਂ ਹਨ ਜਿਵੇਂ ਕਿ ਅਸੀਂ ਵੱਖ ਵੱਖ ਧਰਮਾਂ ਦੇ ਲੋਕਾਂ ਨੂੰ ਆਪਣੀ ਟੀਮ 'ਚ ਰੱਖ ਕੇ ਉਹਨਾਂ ਨੂੰ ਸਮਝ ਸਕਦੇ ਹਾਂ ਉਹਨਾਂ ਦੀ ਭਾਸ਼ਾ ਅਤੇ ਉਹਨਾਂ ਦੇ ਤਰੀਕੇ ਨੂੰ ਵੀ ਸਮਝ ਸਕਦੇ ਹਨ ਇਸ ਦੇ ਨਾਲ਼ ਸਾਨੂੰ ਇੱਕ ਬਹੁਤ ਹੀ ਵਧੀਆ ਤਰ੍ਹਾਂ ਦੀਆਂ ਕੁਆਲਿਟੀਜ਼ ਵੀ ਮਿਲ ਸਿੱਖਣ ਨੂੰ ਮਿਲਦੀਆਂ ਹਨ ਜਿਵੇਂ ਕਿ ਅਸੀਂ ਉਹਨਾਂ ਦੇ ਨਾਲ਼ ਇੱਕ ਭਾਈਚਾਰਾ ਦੇ ਤਰੀਕੇ ਦੇ ਨਾਲ਼ ਰਹਿੰਦੇ ਹਨ ਅਤੇ ਉਹਨਾਂ ਨੂੰ ਪੂਰੀ ਚੰਗੀ ਤਰ੍ਹਾਂ ਸਮਝਦੇ ਹਨ ਅਤੇ ਇਸ ਦੇ ਨਾਲ਼ ਸਾਡੇ ਅੰਦਰ ਪੂਰਾ ਜੋਸ਼ ਰਹਿੰਦਾ ਹੈ ਅਤੇ ਅਸੀਂ ਆਪਣੇ ਅੰਦਰ ਦੀਆਂ ਖੂਬੀਆਂ ਨੂੰ ਬਾਹਰ ਕੱਢਦੇ ਹਾਂ ਇਸ ਦੇ ਨਾਲ਼ ਨਾਲ਼ ਸਾਨੂੰ ਇੱਕ ਪੂਰੀ ਟੀਮ ਨੂੰ ਸਾਥ ਨਾਲ਼ ਲੈ ਕੇ ਚੱਲਣ ਦਾ ਸਾਥ ਵੀ ਮਿਲ ਜਾਂਦਾ ਹੈ ਅਤੇ ਉਹਨਾਂ ਨੂੰ ਸਮਝਣ ਦਾ ਵੀ ਖੇਡਾਂ ਬਹੁਤ ਹੀ ਵਧੀਆ ਹਨ ਜਿਸ ਦੇ ਨਾਲ਼ ਅਸੀਂ ਆਪਣੇ ਅੰਦਰ ਨੂੰ ਭਵ ਪਿਆਰ ਦੀ ਭਾਵਨਾ ਅਤੇ ਖੁਸ਼ੀ ਨੂੰ ਵੀ ਜ਼ਾਹਰ ਕਰ ਸਕਦੇ ਹਨ ਅਤੇ ਇਸਨੂੰ ਅਪਣਾਉਣ ਦੇ ਨਾਲ਼ ਨਾਲ਼ ਸਾ ਅਸੀਂ ਆਪਣੇ ਪਰਿਵਾਰ ਨੂੰ ਵੀ ਸਮਝਾ ਸਕਦੇ ਹਨ ਕਿ ਅਸੀਂ ਖੇਡਾਂ ਤੋਂ ਕੀ ਸਿੱਖ ਰਹੇ ਹਨ ਤਾਂ ਸਾਨੂੰ ਕੀ ਫਾਇਦਾ ਹੋ ਰਿਹਾ ਹੈ ਬਟ ਅਸਲ ਵਿੱਚ ਖੇਡਾਂ ਨੂੰ ਖੇਡਣ ਲਈ ਸਾਨੂੰ ਬਹੁਤ ਹੀ ਮਿਹਨਤ ਕਰਨੀ ਚਾਹੀਦੀ ਹੈ ਅਤੇ ਇਹਨਾਂ ਉੱਤੇ ਜ਼ੋਰ ਦੇਣਾ ਚਾਹੀਦਾ ਹੈ ਇਸ ਦੇ ਨਾਲ਼ ਸਾਡਾ ਸਰੀਰ ਵੀ ਤੰਦਰੁਸਤ ਰਹਿੰਦਾ ਹੈ ਅਤੇ ਸਾਡੀਆਂ ਖੂਬੀਆਂ ਵੀ ਬਾਹਰ ਨਿਕਲ ਕੇ ਬਹੁਤ ਹੀ ਚੰਗੇ ਤਰੀਕੇ ਨਾਲ਼ ਆਉਂਦੀਆਂ ਹਨ ਜੇ ਅਸੀਂ ਇਹਨਾਂ ਨੂੰ ਪ੍ਰੋਪਰ ਜਿਹੇ ਤਰੀਕੇ ਨਾਲ਼ ਸਮਝਾਏ ਸਮ ਸਮਝਿਆ ਜਾਵੇ ਤਾਂ ਸਾਡੇ ਅੰਦਰਲੀਆਂ ਲੀਡਰਸ਼ਿਪ ਕੁਆਲਿਟੀਜ਼ ਵੀ ਬਾਹਰ ਆਉਂਦੀਆਂ ਹਨ ਤਾਂ ਜੋ ਅਸੀਂ ਚਾਰ ਜਣਿਆਂ ਦਾ ਸਮੂਹ ਜਾਂ ਦਸ ਜਣਿਆਂ ਦਾ ਸਮੂਹ ਨੂੰ ਕਿਵੇਂ ਨਾਲ਼ ਲੈ ਕੇ ਤੁਰਦੇ ਹਨ ਅਤੇ ਰਲ਼ ਮਿਲ ਕੇ ਇੱਕ ਨਤੀਜੇ ਉੱਪਰ ਆਉਂਦੇ ਹਨ ਜਿਸ ਦੇ ਕਾਰਨ ਸਾਨੂੰ ਬਹੁਤ ਹੀ ਵਧੀਆ ਮਹਿਸੂਸ ਹੁੰਦਾ ਹੈ ਅਤੇ ਅਸੀਂ ਆਪਣੀ ਜਿੱਤ ਹਾਸਲ ਕਰਕੇ ਜੇਤੂ ਕਹਿਲਾਏ ਜਾਂਦੇ ਹਨ